ਹੈਲੋ ਹਾਂਜੀ ਅੱਛਿਆ ਨਹੀਂ ਨਿਊ ਐਡਮਿਸ਼ਨ ਐ ਛੋਟੇ ਨਾ ਬੱਚੇ ਜੇ ਤੇ ਉਹ ਫੇਰ ਆਪਾਂ ਜੋਤੀ ਕਿੱਡ ਕੇਅਰ ਕਰਾਓ ਸਰ ਨਾਲੋਂ ਵਧੀਆ ਹੈਗਾ ਅੱਛਿਆ ਅੱਛਿਆ ਫਿਰ ਆਪਣਾ ਜਿਹੜਾ ਆਤਮਬਲਾ ਸਕੂਲ ਸਹੀ ਵਧੀਆ ਹੈਗਾ ਜਿਹੜਾ ਉਨਦੇ ਗਾ ਕਿਸੇ ਫਾਲਕ ਦੇ ਆਪਣੇ ਸਰਵਅਧਿਆਕੀਰ ਹੈਗਾ ਜਿਵੇਂ ਸਸਤਾ ਸਕੂਲ ਐ ਬੜਾ ਵੱਡਾ ਸਕੂਲ ਐ ਤੇ ਸਾਰੇ ਆਪਣੇ ਟੀਚਰ ਵੀ ਵਧੀਆ ਨੇ ਉੱਥੇ ਹੋਰ ਹੈਗੇ ਤਾਂ ਬੜੇ ਨੇ ਜਿਵੇਂ ਹੋਲੀ ਆਰਟ ਹੈਗਾ ਉਹ ਅਗਰਸੈਕਰਟਲ ਹੈਗਾ ਤੇ ਪਰ ਇਹ ਜਿਹੜਾ ਹੈਗਾ ਸੀਬੀਐਸਈ ਦਾ ਸਲੇਬਸ ਐ ਇੱਥੇ ਸਾਰਾ ਸਰਵਅਧਿਕਾਰੀ ਚ ਵਧੀਆ ਸਕੂਲ ਏ ਉਹ ਹੈਗਾ ਸਕੂਲ ਠੀਕ ਪਰ ਥੋੜਾ ਦੂਰ ਪੈਂਦਾ ਉਹ ਮਤਲਬ ਜੇ ਸਰਵਅਧਿਕਾਰੀ ਸ਼ਹਿਰ ਦੇ ਵਿੱਚ ਰਹਿ ਜਾਂਦਾ ਉਹ ਸ਼ਹਿਰ ਤੋਂ ਬਾਹਰ ਏ ਆਹੋ ਵੈਨ ਤਾਂ ਲੱਗੀ ਈ ਹੋਨੀ ਆ ਉਹ ਤਾਂ ਗੱਲ ਸਹੀ ਏ ਉਹ ਵੀ ਸਕੂਲ ਤਾਂ ਵਧੀਆ ਬਸ ਸਟ੍ਰਿਕਨੈਸ ਉੱਥੇ ਬਹੁਤ ਹੈਗੀ ਐ ਹਾਂ ਉਹ ਪ੍ਰਿੰਸੀਪਲ ਟੀਚਰ ਟੀਚਰਾਂ ਨੂੰ ਬਹੁਤ ਖਿੱਚ ਕੇ ਰੱਖਦੀ ਐ ਉਹ ਉੱਥੋਂ ਇਹ ਤਾਂ ਹੈਗਾ ਈ ਐ ਬੱਚਿਆਂ ਵਾਸਤੇ ਤਾਂ ਵੈਸੇ ਉਂਝ ਉਹ ਹਾਂ ਠੀਕ ਐ ਜੀ ਗੱਲ ਤਾਂ ਕੋ ਨੀ ਹੈਗੀ ਔਰ ਫੀਸਾਂ ਦੇਖੋ ਜਿੰਨੀਆਂ ਏਨਾ ਜਿੰਨੀ ਕ ਉਹਨਾਂ ਦੀ ਐ ਉਨੀ ਉਧਰ ਹੈਗੀ ਏ ਉਹ ਦੇਖੋ ਜੀ ਉਹ ਕੋਈ ਫਰਕ ਨੀ ਹੈਗਾ ਨਹੀਂ ਬੱਚੇ ਦੀ ਕੇਅਰ ਤੁਹਾਡੇ ਨਾਲੋਂ ਉੱਥੇ ਬੜੀ ਵਧੀਆ ਦੇਖ ਭਾਲ ਐ ਇਹੋ ਜਿਹੀ ਗੱਲ ਨੀ ਹੈਗੀ ਫਸਟ ਕਲਾਸ ਐ ਉੱਥੇ ਹਾਂ ਹਾਂ ਉਹ ਉਹ ਉੱਥੇ ਵਧੀਆ ਉਹਦੇ ਨਾਲੋਂ ਉਹ ਸਕੂਲ ਦੇ ਵਿੱਚ ਨਾਲੇ ਉਹ ਮੈਡਮ ਤਿੰਨ ਹੈਗੀ ਉੱਥੇ ਪ੍ਰਿੰਸੀਪਲ ਹਾਂ ਉਹ ਸਾਰਾ ਦੇਖਦੀ ਵੀ ਵਧੀਆ ਚਲ ਕੋਈ ਨੀ ਆਪਾਂ ਕਰਾਲਾਂਗੇ ਦੇਖ ਆਇਓ ਤੁਸੀਂ ਵੀ ਬਣਾਲੋ ਵਿਚਾਰ ਫੇਰ ਆਪਾਂ ਚਲਦੇ ਰਹਿੰਦੇ ਸਕੂਲ ਹੋਰ

ਹਾਂ ਕੋਈ ਨੀ ਚੱਲ ਦੇਖਕੇ ਗੱਲ ਕਰਕੇ ਆ ਜਾਨੇ ਆਂ ਕੋਈ ਨੀ ਕਰ ਆਂਦੇ ਆਂ ਠੀਕ ਓਕੇ